ਮੈਂ ਇੱਕ ਦਿਨ ਮਿਸਟਰ ਦੀਪਕ ਕੁਮਾਰ ਦੇ ਨਾਲ ਲੁਧਿਆਣੇ ਜਲੰਧਰ ਤੋਂ ਲੁਧਿਆਣੇ ਗਿਆ ਉਸ ਦਾ ਸਫ਼ਰ ਬਹੁਤ ਹੀ ਅੱਛਾ ਰਿਹਾ ਫਿਰ ਮੈਂ ਦੀਪਕ ਕੁਮਾਰ ਦੇ ਨਾਲ ਇੱਕ ਵਾਰ ਲੁਧਿਆਣੇ ਤੋਂ ਲੁਧਿਆਣੇ ਗਿਆ ਉਸਦਾ ਵਿੱਚ ਜਦੋਂ ਮੈਨੂੰ ਘਰੋਂ ਆਇਆ ਪਿੱਕ ਕਰਨ ਅਤੇ ਮੈਂ ਉਹਦੇ ਨਾਲ ਜਾ ਕੇ ਲੁਧਿਆਣੇ ਦਾ ਸਫ਼ਰ ਦਾ ਅਹਿਸਾਸ ਲਿਆ ਕਿਉਂਕਿ ਅਸੀਂ ਦੋਨਾਂ ਨੇ ਬਾਈਕ 'ਤੇ ਹੀ ਸਫ਼ਰ ਤੈਅ ਕੀਤਾ ਜਦੋਂ ਮੈਨੂੰ ਘਰ ਆਇਆ ਤਾਂ ਮੈਂ ਉਹਦੀ ਪਿਛਲੀ ਸੀਟ 'ਤੇ ਬਹਿ ਕੇ ਕੰਫਰਟਏਬਲ ਆਪਾਂ ਦੋਨੋਂ ਜਾਂਦੇ ਰਹੇ ਜੋ ਕਿ ਰਸਤੇ ਦੇ ਵਿੱਚ ਬਹੁਤ ਅੱਛੇ ਅਸੀਂ ਗਰੀਨੀਇਸ਼ ਔਰ ਵਾਤਾਵਰਨ ਵੀ ਦੇਖਦੇ ਰਹੇ ਜੋ ਕਿ ਇੱਕ ਖੁਸ਼ਹਾਲੀ ਦਾ ਕਾਰਨ ਵੀ ਬਣਿਆ ਜਿਸ ਨਾਲ ਦੋਨੋ ਹੀ ਅਸੀਂ ਆਪਸ ਡਿਸਕਸ਼ਨ ਵੀ ਕਰਦੇ ਗਏ ਕੰਮ ਦੇ ਪ੍ਰਤੀ ਅਤੇ ਨਾਲ ਸਫ਼ਰ ਵੀ ਘੱਟਦਾ ਗਿਆ ਦੋਨੋ ਜਣੇ ਹੀ ਇੱਕ ਜਦੋਂ ਥੋੜ੍ਹਾ ਰਸਤੇ 'ਚ ਫਗਵਾੜਾ ਆਇਆ ਅਸੀਂ ਥੋੜ੍ਹਾ ਸਟੇਅ ਵੀ ਕੀਤਾ ਉਸ ਨਾਲ ਅਸੀਂ ਰੁਕ ਕੇ ਥੋੜ੍ਹਾ ਪਾਣੀ ਜੂਸ ਦਾ ਸੇਵਨ ਵੀ ਕੀਤਾ ਉਸ ਦੇ ਬਾਅਦ ਅਸੀਂ ਫਿਰ ਅੱਗੇ ਲੁਧਿਆਣਾ ਕਰੋਸ ਕਰਨ ਤੋਂ ਬਾਅਦ ਮਾਰਕੀਟ ਦੇ ਵਿੱਚ ਇੰਟਰ ਕਰਕੇ ਜਿਸ ਨਾਲ ਸਾਡੀ ਮਾਰਕੀਟ ਦਾ ਵੀ ਕੰਮ ਹੋ ਗਿਆ ਮਾਰਕੀਟ ਦਾ ਸਾਰਾ ਇੱਕ ਇੱਕ ਸ਼ੋਪ ਤੋਂ ਦੂਜੀ ਸ਼ੋਪ 'ਤੇ ਵੀ ਜਾਂਦੇ ਰਹੇ ਨਾਲੇ ਅਸੀਂ ਆਪਸ 'ਚ ਡਿਸ਼ਕਸ਼ਨ ਵੀ ਕਰਦੇ ਰਹੇ